ਮੈਂ ਆਪਣੇ ਟੀਚੇ ਆਪਣੇ ਬਵਿੱਛਯ ਨੂੰ ਲੈ ਕੇ ਨਿਰਧਾਰਿਤ ਕਰਦੀ ਹਾਂ ਕਿ ਆਉਣ ਵਾਲੇ ਬਵਿਛ ਭਵਿੱਖ ਵਿੱਚ ਮੈਂ ਕੀ ਬਣਨਾ ਚਾਹੁੰਦੀ ਹਾਂ ਅਤੇ ਆਪਣੇ ਆਪ ਨੂੰ ਭਵਿੱਖ ਵਿੱਚ ਕਿੱਥੇ ਦੇਖਣਾ ਚਾਹੁੰਦੀ ਹਾਂ ਆਹੀ ਸੋਚ ਕੇ ਮੈਂ ਆਪਦੇ ਜਿਹੜੇ ਜ਼ਿੰਦਗੀ ਦੇ ਟੀਚੇ ਹੈ ਉਹ ਨਿਰਧਾਰਿਤ ਕੀਤੇ ਹੋਏ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਮੈਂ ਕੁਛ ਤਾਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਅਨੁਸ਼ਾਸਿਤ ਰੱਖਣਾ ਜ਼ਰੂਰੀ ਹੁੰਦਾ ਹੈ ਅਤੇ ਰੋਜ਼ ਥੋੜ੍ਹੇ ਥੋੜ੍ਹੇ ਪਰਿਆਸ ਕਰਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਤਲਬ ਤੁਹਾਨੂੰ ਹਰ ਰੋਜ਼ ਬਿਨਾ ਕਿਸੇ ਰੁਕਾਵਟ ਤੋਂ ਉਨ੍ਹਾਂ ਟ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਉਹਨੂੰ ਆਪਣੇ ਕਾਬਲ ਬਣਾਉਣਾ ਮਤਲਬ ਇਹ ਕਰਨੇ ਚਾਹੀਦੇ ਆਪਾਂ ਨੂੰ ਅਤੇ ਮੇਰੀ ਦੂਜਿਆਂ ਨੂੰ ਵੀ ਆਹੀ ਸਲਾਹ ਹੈ ਕਿ ਆਪਣੇ ਜਿਹੜੇ ਟੀਚੇ ਆ ਉਹ ਤੁਸੀਂ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ ਹੋ ਉਨ੍ਹਾਂ ਨੂੰ ਜ਼ਰੂਰ ਨਿਰਧਾਰਿਤ ਕਰੋ ਅਤੇ ਉਹ ਉਹਨਾਂ ਨੂੰ ਪ੍ਰਾਪਤ ਕਰਨ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਜਿਹੜੀ ਹੈ ਕਿ ਆਪਾਂ ਨੂੰ ਸਫਲਤਾ ਮਿਲਦੀ ਹੈ ਅਤੇ ਮਤਲਬ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਹ ਜ਼ਰੂਰ ਆਪਣੇ ਦਿਮਾਗ 'ਚ ਬਿਠਾਓ ਕਿ ਉਹ ਕੰਮ ਤੁਹਾਡੇ ਲਈ ਕਿੰਨਾ ਕੁ ਜ਼ਰੂਰੀ ਹੈ ਉਹ ਟੀਚਾ ਪ੍ਰਾਪਤ ਕਰਨਾ ਤੁਹਾਡੇ ਲਈ ਕਿੰਨਾ ਕੁ ਜ਼ਰੂਰੀ ਹੈ ਅਤੇ ਤੁਸੀਂ ਫੇਰ ਆਪਣੇ ਦਿਮਾਗ ਨੂੰ ਆਪਣੇ ਪੂਰੇ ਕੰਸਟ੍ਰੇਸ਼ਨ ਦੇ ਨਾਲ ਬੈਠ ਕੇ ਸੋਚ ਕੇ ਫੇਰ ਆਪਦੇ ਟੀਚੇ ਨਿਰਧਾਰਿਤ ਕਰੋ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਤੁਸੀਂ ਕੀ ਕੁਛ ਕਰ ਸਕਦੇ ਹੋ ਤੁਹਾਡੀ ਕਿਹੜੀ ਕਮਜ਼ੋਰੀਆਂ ਨੇ ਕਿਹੜੀ ਤੁਹਾਡੀ ਮਤਲਬ ਕਿਹੜੀ ਕਮੀਆਂ ਨੇ ਉਨ੍ਹਾਂ ਨੂੰ ਕਿਵੇਂ ਦੂਰ ਕਰਨਾ ਆਹ ਵੀ ਸੋਚੋ ਅਤੇ ਮੇਰਾ ਜਿਹੜਾ ਪਸੰਦੀਦਾ ਦੌੜਾਕ ਹੈ ਉਹ ਉਸੈਨ ਬੋਲਟ ਹੈ ਧੰਨਿਆਵਾਦ